ਹੈਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਹਾਂਜੀ ਜੀ ਹੁਕਮ ਕਰੋ ਜੀ ਹਾਂਜੀ ਹਾਂਜੀ ਵਾਹਿਗੁਰੂ ਜੀ ਆਪਣੇ ਹਾਂਜੀ ਗ੍ਰੰਥੀ ਸਿੰਘ ਆਪਣੇ ਕੋਲ ਹੈ ਨਵੇਂ ਆਏ ਆ ਜੀ ਹਾਂਜੀ ਅਤੇ ਆਪਾਂ ਉਪਰਾਲਾ ਸ਼ੁਰੂ ਕੀਤਾ ਕਿ ਜਿਹੜੇ ਆਪਣੇ ਬੱਚੇ ਆ ਛੋਟੇ ਵੱਡੇ ਜਾਂ ਕੋਈ ਵੀ ਆ ਬੱਚੇ ਆਪਣੇ ਉਹਨਾਂ ਨੂੰ ਜਿਹੜੀ ਗੁਰਬਾਣੀ ਦੀ ਸੰਥਿਆ ਆਪਾਂ ਸ਼ੁਰੂਆਤ ਕੀਤੀ ਹਾਂਜੀ ਹਾਂਜੀ ਜਦੋਂ ਮਰਜ਼ੀ ਕੱਲ੍ਹ ਤੋਂ ਭੇਜ ਦਿਓ ਜੀ ਭਵਾ ਕੋਈ ਗੱਲ ਨਹੀਂ ਆਪਣੇ ਟਾਈਮ ਦੇਖੋ ਜੀ ਬੱਚਿਆਂ ਨੇ ਸਕੂਲ ਲਈ ਵੀ ਜਾਣਾ ਹੁੰਦਾ ਨਾ ਸਵੇਰ ਦਾ ਟਾਈਮ ਤਕਰੀਬਨ ਦੋ ਤਿੰਨ ਵਜੇ ਤੱਕ ਆਪਾਂ ਸ਼ਾਮ ਦਾ ਟਾਈਮ ਰੱਖਿਆ ਆ ਵੀ ਸਾਰੇ ਬੱਚੇ ਕੁੱਲ ਤਕਰੀਬਨ ਫਰੀ ਹੋ ਜਾਂਦੇ ਆ ਸਾਢੇ ਕੁ ਚਾਰ ਵਜੇ ਤੋਂ ਸਾਢੇ ਕੁ ਪੰਜ ਵਜੇ ਤੱਕ ਨਾ ਹਾਂਜੀ ਹਾਂਜੀ ਤੁਸੀਂ ਭਵਾ ਕੱਲ੍ਹ ਤੋਂ ਬੱਚੇ ਨੂੰ ਭੇਜਣਾ ਸ਼ੁਰੂ ਕਰ ਦਿਓ ਜੀ ਪੂਰੀ ਸੰਥਿਆ ਜਿਹੜੀ ਗੁਰਬਾਣੀ ਦੀ ਦਿੱਤੀ ਜਾਊਗੀ ਨਿਤਨੇਮ ਪੰਜਾਂ ਬਾਣੀਆਂ ਦੀ ਪੰਜ ਪੌੜੀਆਂ ਪਹਿਲਾਂ ਨਾਲ ਵੀ ਕੀਰਤਨ ਵੀ ਆਪਾਂ ਸਿਖਾਉਂਦੇ ਹਾਂ ਬੱਚਿਆਂ ਨੂੰ ਨਾਲ ਹੌਲੀ ਹੌਲੀ ਕੀਰਤਨ ਵੀ ਨਾਲ ਸਿੰਘ ਆਪਣੇ ਕੋਲ ਜਿਹੜੇ ਗ੍ਰੰਥੀ ਸਿੰਘ ਆਏ ਉਹਨਾਂ ਨੂੰ ਗੱਤਕਾ ਵੀ ਆਉਂਦਾ ਗੱਤਕਾ ਦੀ ਵੀ ਸਿਖਲਾਈ ਦਿਆ ਕਰਨਗੇ ਨਾਲ ਹਾਂਜੀ ਨਹੀਂ ਨਹੀਂ ਵਾਹਿਗੁਰੂ ਫੀਸ ਕੋਈ ਨਹੀਂ ਗੀ ਆਪਾਂ ਜੀ ਫਰੀ ਸੇਵਾ ਹੀ ਆ ਸਾਰੀ ਬੱਚਿਆਂ ਨੂੰ ਆਪਾਂ ਜੋੜਨਾ ਵੱਧ ਤੋਂ ਵੱਧ ਜਿਹੜੇ ਆਪਾਂ ਨੇ ਸਿੱਖੀ ਦੇ ਨਾਲ ਅਤੇ ਫੀਸ ਕੋਈ ਨਹੀਂ ਜੀ ਆਪਣੀ ਇਹ ਆਪਾਂ ਬੱਚੇ ਵੱਧ ਤੋਂ ਵੱਧ ਆਉਣ ਨਾਲ ਆਪਾਂ ਜਿਹੜੀ ਆ ਗੁਰਬਾਣੀ ਪੜ੍ਹਨ ਸਿੱਖਣ ਬਾਣੀ ਪੜ੍ਹਨਗੇ ਔਰ ਵਧੀਆ ਪਾਸੇ ਲੱਗਣਗੇ

ਠੀ ਠੀ ਠੀਕ ਹੈ ਜੀ ਠੀਕ ਹੈ ਜੀ ਚੰਗਾ ਜੀ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ ਜੀ